ਪੇਂਡੂ ਲੋਕਾਂ ਨੂੰ ਅ ਕਾਨੂੰਨੀ ਸੇਵਾਵਾਂ ਦੇ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਵਕੀਲ ਪੜ੍ਹੇ ਲਿਖੇ ਵਕੀਲ ਅੱਛੇ ਵਕੀਲ ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਹੀ ਅਦਾਲਤ ਹੁੰਦੀਆਂ ਨੇ ਇਸ ਲਈ ਜਦੋਂ ਪੇਂਡੂ ਲੋਕਾਂ ਨੂੰ ਇਸ ਵਕੀਲਾਂ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਆਉਣਾ ਪੈਂਦਾ ਵਕੀਲਾਂ ਜ਼ਿਆਦਾਤਰ ਮੈਂ ਇਹ ਦੇਖਿਆ ਕਿ ਜਿਵੇਂ ਮੈਂ ਪਟਿਆਲਾ ਦੇ ਵਿੱਚ ਰਹਿੰਦੀ ਰਹਿੰਦੀ ਤਾਂ ਲਾਗੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਕੇਸਿਸ ਦੇ ਲਈ ਪਟਿਆਲਾ ਦੇ ਵਿੱਚ ਹੀ ਆਉਂਦੇ ਨੇ ਬਹੁਤ ਜਦੋਂ ਘੱਟ ਸੰਖਿਆ ਵਾਲੇ ਪਿੰਡ ਹੁੰਦੇ ਨੇ ਜਿਹਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਬਹੁਤ ਘੱਟ ਹੈ ਉੱਥੇ ਪੁਲਿਸ ਸਟੇਸ਼ਨ ਵੀ ਨਹੀਂ ਹੁੰਦੇ ਉਹਨਾਂ ਨੂੰ ਕਿਸੇ ਵੀ ਵਾਰਦਾਤ ਦੇ ਲਈ ਨੇੜੇ ਦੇ ਡਿਸਟ੍ਰਿਕ ਦੇ ਵਿੱਚ ਆਪਣੀ ਅ ਕੰਪਲੇਂਟ ਲਿਖਵਾਉਣੀ ਪੈਂਦੀ ਆ